ਹਾਂਜੀ ਮੈਂ ਗੀਤ ਸੁਣਨਾ ਬਹੁਤ ਪਸੰਦ ਕਰਦਾ ਹਾਂ ਮੈਨੂੰ ਪੰਜਾਬੀ ਗੀਤ ਸੁਣਨੇ ਬਹੁਤ ਪਸੰਦ ਹੈ ਮੇਰਾ ਮਨਪਸੰਦ ਗਾਇਕ ਸਿੱਧੂ ਮੁਸੇਵਾਲਾ ਹੈ ਕਿਉਂਕਿ ਉਸ ਦੇ ਗਾਣੇ ਬਹੁਤ ਹੀ ਵਧੀਆ ਹੁੰਦੇ ਹਨ ਅਤੇ ਮੈਂ ਉਹਨਾਂ ਨੂੰ ਸੁਣ ਕੇ ਰਿਲੈਕਸ ਫ਼ੀਲ ਕਰਦਾ ਹਾਂ ਅੱਜ ਕੱਲ੍ਹ ਦੇ ਜੋ ਛੋਟੇ ਬੱਚੇ ਹਨ ਉਹ ਵੀ ਬਹੁਤ ਹੀ ਸਿੱਧੂ ਮੁਸੇਵਾਲੇ ਦੇ ਫੈਨ ਹਨ ਅਤੇ ਮੇਰੇ ਸਥਾਨਕ ਗੀਤਕਾਰ ਬਾਰੇ ਜੋ ਕਿ ਉਨ੍ਹਾਂ ਦਾ ਨਾਮ ਹੈ ਸੁਰਜੀਤ ਸਿੰਘ ਬਿਦਰਖੀਆ ਉਹ ਸਾਡੇ ਇਲਾਕੇ ਨਾਲ ਸੰਬੰਧ ਰੱਖਦੇ ਹਨ